ਅਸੀਂ ਜਿਵੇਂ ਕਿ ਕਹਿ ਸਕਦੇ ਹਾਂ ਸਾਡੀ ਸਰਕਾਰ ਨੂੰ ਟੂਰਿਸਟ ਪਲੇਸਾਂ ਲਈ ਬਹੁਤ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ ਅਤੇ ਸਾਡੀ ਸਰਕਾਰ ਨੂੰ ਇਹ ਬੇਨਤੀ ਹੈ ਕਿ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਜਦੋਂ ਅਸੀਂ ਵੀ ਜਦੋਂ ਕੋਈ ਵੀ ਲੋਕ ਘੁੰਮਣ ਜਾਂਦੇ ਹਨ ਅਤੇ ਉਹ ਟੂਰਿਸਟ ਪਲੇਸਾਂ ਨੂੰ ਦੂਸ਼ਿਤ ਕਰਦੇ ਹਨ ਅਤੇ ਬਹੁਤ ਹੀ ਕੂੜਾ ਕਚਰਾ ਫੈਲਾਉਂਦੇ ਹਨ ਅਤੇ ਸਾਨੂੰ ਉਸ ਚੀਜ਼ ਨੂੰ ਰੋਕਣਾ ਚਾਹੀਦਾ ਹੈ ਸਾਨੂੰ ਕਿਸੇ ਵੀ ਟੂਰਿਸਟ ਪਲੇਸ ਵਿੱਚ ਗੰਦਗੀ ਨਹੀਂ ਫੈਲਾਉਣੀ ਚਾਹੀਦੀ ਹੈ ਅਤੇ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਮਿੰਨੀ ਗੋਆ ਹੋ ਗਿਆ ਰਣਜੀਤ ਸਾਗਰ ਡੈਮ ਹੋ ਗਿਆ ਮਿਨੀ ਗੋਆ ਵਿੱਚ ਥਾਂ ਥਾਂ 'ਤੇ ਤੁਸੀਂ ਵੇਖ ਸਕਦੇ ਹੋ ਕੂੜਾ ਕਚਰਾ ਲੋਕ ਫੈਲਾਉਂਦੇ ਹਨ ਉੱਥੇ ਕਈ ਤਰ੍ਹਾਂ ਦੇ ਚੀਜ਼ਾਂ ਮਿਲਦੀਆਂ ਹਨ ਖਾਣ ਨੂੰ ਅਤੇ ਲੋਕ ਉਸ ਨੂੰ ਡਸਟਬਿਨ ਵਿੱਚ ਨਾ ਸੁੱਟ ਕੇ ਲੋਕ ਇੱਧਰ ਉੱਧਰ ਸੁੱਟ ਦਿੰਦੇ ਹਨ ਜਿਵੇਂ ਕਿ ਪਾਣੀ ਦੇ ਗਲਾਸ ਹੋ ਗਏ ਪਾਣੀ ਦੀਆਂ ਬੋਤਲਾਂ ਹੋ ਗਈਆਂ ਅਤੇ ਲੋਕ ਉਹਨੂੰ ਇੱਧਰ ਉੱਧਰ ਸੁੱਟ ਦਿੰਦੇ ਹਨ ਅਤੇ ਉਹਨੂੰ ਡਸਟਬਿਨ ਵਿੱਚ ਨਹੀਂ ਸੁੱਟਦੇ ਹਨ ਅਤੇ ਅਸੀਂ ਕਿ ਜਿਵੇਂ ਕਹਿ ਸਕਦੇ ਹਾਂ ਕਿ ਮਿੰਨੀ ਗੋਆ ਵਿੱਚ ਇੱਕ ਚੀਜ਼ ਹੋਰ ਹੈ ਕਿ ਉਹ ਕਈ ਲੋਕ ਆਪਣੇ ਖੇਤਾਂ ਵਿੱਚ ਗਾਂ ਅਤੇ ਆਪਣੇ ਕੁੱਤੇ ਬਿੱਲੀਆਂ ਨੂੰ ਘਰੋਂ ਹੀ ਛੱਡ ਦਿੰਦੇ ਹਨ ਘਰੋਂ ਹੀ ਕੱਢ ਦਿੰਦੇ ਹਨ ਅਤੇ ਉਹ ਮੱਝ ਅਤੇ ਗਾਵਾਂ ਇੱਧਰ ਉੱਧਰ ਫਿਰਦੀਆਂ ਰਹਿੰਦੀਆਂ ਹਨ ਅਤੇ ਉਹ ਉਸ ਜਗ੍ਹਾ ਨੂੰ ਦੂਸ਼ਿਤ ਕਰਦੀਆਂ ਹਨ ਮਤਲਬ ਜਿਵੇਂ ਕੂੜਾ ਫੈਲਾਉਂਦੀਆਂ ਹਨ ਉਸ ਕੂੜੇ ਨੂੰ ਖਾ ਜਾਂਦੀਆਂ ਹਨ ਅਤੇ ਉਹ ਉਹਨਾਂ ਲਈ ਵੀ ਬਹੁਤ ਹਾਨੀਕਾਰਕ ਹਨ ਅਤੇ ਉਸ ਜਗ੍ਹਾ ਨੂੰ ਸਾਨੂੰ ਉਸ ਚੀਜ਼ ਨੂੰ ਵੀ ਰੋਕਣਾ ਚਾਹੀਦਾ ਹੈ ਕਿ ਕੋਈ ਪਸ਼ੂ ਉੱਥੇ ਨਾ ਦਿਖਣ ਅਤੇ ਕੋਈ ਕੂੜਾ ਕਚਰਾ ਵੀ ਨਾ ਦਿਖੇ ਉੱਥੇ ਤਾਂ ਦੂਸਰੀ ਚੀਜ਼ ਇਹ ਸਾਨੂੰ ਸਾਡੀ ਸਰਕਾਰ ਨੂੰ ਸੜਕਾਂ ਉੱਤੇ ਬਹੁਤ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਥਾਂ ਥਾਂ ਵਿੱਚ ਸੜਕਾਂ ਵਿੱਚ ਗੱਡੇ ਹੁੰਦੇ ਹਨ ਸੜਕਾਂ ਖ਼ਰਾਬ ਹੁੰਦੀਆਂ ਹਨ ਸੜਕਾਂ ਵਿੱਚ ਪਾਣੀ ਭਰਿਆ ਹੁੰਦਾ ਆ ਅਤੇ ਉਸ ਵਿੱਚ ਉਸ ਕਾਰਨ ਕਈ ਮੱਛਰ ਆ ਜਾਂਦੇ ਹਨ ਜਿਵੇਂ ਕਿ ਉਹ ਉਹ ਬਹੁਤ ਹੀ ਦੂਸ਼ਿਤ ਕਰਦੇ ਹਨ ਅਤੇ ਉਸ ਤੋਂ ਬਹੁਤ ਹੀ ਜ਼ਿਆਦਾ ਬਿਮਾਰੀਆਂ ਫੈਲਦੀਆਂ ਹਨ ਜਿਵੇਂ ਕਿ ਡੇਂਗੂ ਹੋ ਗਿਆ ਮਲੇਰੀਆ ਹੋ ਗਿਆ ਅਤੇ ਕਈ ਲੋਕ ਬਹੁਤ ਜ਼ਿਆਦਾ ਬਿਮਾਰ ਵੀ ਪੈ ਜਾਂਦੇ ਹਨ ਜੇ ਤੁਸੀਂ ਰਣਜੀਤ ਸਾਗਰ ਡੈਮ ਦੇਖ ਸਕਦੇ ਹੋ ਅਤੇ ਕਈ ਲੋਕ ਪਾਣੀ ਵਿੱਚ ਵੀ ਪਾਣੀ ਨੂੰ ਵੀ ਗੰਦਾ ਕਰਦੇ ਹਨ ਅਤੇ ਉੱਥੇ ਕੂੜਾ ਵਗੈਰਾ ਸੁੱਟ ਦਿੰਦੇ ਹਨ ਸਾਨੂੰ ਇਹ ਚੀਜ਼ ਨੂੰ ਰੋਕਣਾ ਚਾਹੀਦਾ ਆ ਅਤੇ ਸਾਨੂੰ ਇਸ ਉੱਤੇ ਇਸ 'ਤੇ ਉੱਤੇ ਐਕਸ਼ਨ ਲੈਣਾ ਚਾਹੀਦਾ ਹੈ ਅਤੇ ਸਾਡੀ ਸਰਕਾਰ ਨੂੰ ਇਹ ਹੀ ਬੇਨਤੀ ਹੈ ਕਿ ਸਭ ਤੋਂ ਜ਼ਿਆਦਾ ਕੂੜਾ ਕਚਰਾ ਅਤੇ ਸਾਡੀ ਸੜਕਾਂ ਨੂੰ ਵੱਧ ਤੋਂ ਵੱਧ ਠੀਕ ਕੀਤਾ ਜਾਵੇ